ਅਗਰ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਕਨੇਡਾ ਦੀ ਯਾਤਰਾ ਕਰਨਾ ਚਾਹੁੰਦਾ ਹਾਂ ਕਿਉਂਕਿ ਉੱਥੇ ਮੇਰੀ ਛੋਟੀ ਭੈਣ ਰਹਿੰਦੀ ਹੈ ਉਹ ਮੈਨੂੰ ਆਸਾਨੀ ਨਾਲ ਬੁਲਾ ਸਕਦੀ ਹੈ ਅਤੇ ਉੱਥੇ ਕਨੇਡਾ ਬਹੁਤ ਹੀ ਚੰਗਾ ਅਤੇ ਸਾਫ਼ ਸੁਥਰਾ ਸ਼ਹਿਰ ਹੈ ਜਿੱਥੇ ਉਹ ਰਹਿੰਦੀ ਹੈ ਉਹ ਇਲਾਕਾ ਬਹੁਤ ਹੀ ਸਾਫ਼ ਸੁਥਰਾ ਅਤੇ ਸ਼ਾਂਤਮਈ ਇਲਾਕਾ ਹੈ ਉਸਦੇ ਨੇੜੇ ਤੇੜੇ ਇੱਕ ਘੁੰਮ ਘੁੰਮਣ ਲਈ ਬਹੁਤ ਹੀ ਚੰਗੀ ਜਗ੍ਹਾ ਹੈ ਜਿਸਨੂੰ ਨਾਇਗਰਾ ਫਾਲ ਕਹਿੰਦੇ ਹਨ ਦੁਨੀਆਂ ਦੂਰੋਂ ਦੂਰੋਂ ਉਸ ਨਾਇਗਰਾ ਫਾਲ ਨੂੰ ਦੇਖਣ ਲਈ ਆਉਂਦੀ ਹੈ ਉੱਥੇ ਘੁੰਮਣ ਆਉਂਦੀ ਹੈ ਇੱਕ ਉੱਥੇ ਉਹ ਕਨੇਡਾ ਦਾ ਇੱਕ ਅਜਿਹਾ ਇਲਾਕਾ ਹੈ ਕਿ ਕਨੇਡਾ ਦਾ ਇੱਕ ਅਜਿਹਾ ਇਲਾਕਾ ਜਿੱਥੇ ਕਿ ਸਸਤਾ ਅਤੇ ਵਧੀਆ ਰਹਿਣ ਨੂੰ ਜਗ੍ਹਾ ਮਿਲ ਜਾਂਦੀ ਹੈ ਅਤੇ ਨਾਲ ਖਾਣ ਪੀਣ ਨੂੰ ਸਸਤਾ ਹੈ ਉਹ ਕੈਨੇਡਾ ਦੇ ਹੋਰ ਇਲਾਕਿਆਂ ਨਾਲੋਂ ਇਸ ਲਈ ਮੈਂ ਉੱਥੇ ਘੁੰਮਣਾ ਚਾਹੁੰਦਾ ਹਾਂ